ਮੈਂ ਬੁਣਾਈ ਅਤੇ ਸਿਲਾਈ ਤੋਂ ਇਲਾਵਾ ਕਰੋਸ਼ੀਏ ਵਿੱਚ ਰੁਚੀ ਰੱਖਦੀ ਹਾਂ ਹਾਂ ਜੀ ਮੈਂ ਸਿਲਾਈ ਅਤੇ ਬੁਣਾਈ ਨੂੰ ਮਿਲਾ ਕੇ ਨਵਾਂ ਬਣਾਉਣ ਦੀ ਕੋਸ਼ਿਸ਼ ਇੱਕ ਜੂੜੇ ਦੀ ਸੂਈ ਧਾਗਾ ਡੋਰੀ ਵਾਲਾ ਮਲਟੀ ਕਲਰ ਕ੍ਰੋਸ਼ੀਆ ਅਤੇ ਕੱਪੜਾ ਲੈ ਕੇ ਕੀਤੀ ਜੂੜੇ ਦੀ ਸੂਈ ਡੋਰੀ ਦੇ ਧਾਗੇ ਨਾਲ ਕਰੋਸ਼ੀਏ ਦੀ ਇੱਕ ਲੈਸ ਬਣਾਈ ਜੋ ਕਿ ਸੱਤ ਮੀਟਰ ਬਣਾਈ ਉਸ ਨੂੰ ਬਾਅਦ ਵਿੱਚ ਮੈਂ ਇੱਕ ਮੀਟਰ ਕੱਪੜਾ ਲਿਆ ਉਸ ਦੇ ਰੁਮਾਲ ਬਣਾਏ ਪੰਜ ਰੁਮਾਲ ਬਣਾਏ ਉਸ ਪੰਜ ਰੁਮਾਲਾਂ ਦੇ ਆਸੇ ਪਾਸੇ ਮੈਂ ਉਹ ਲੈਸ ਲਗਾਈ ਇਸ ਤਰ੍ਹਾਂ ਮੈਂ ਇਹ ਹੀ ਲੈਸ ਬਣਾ ਕੇ ਜੂੜੇ ਦੀ ਸੂਈ ਅਤੇ ਕ੍ਰੋਸ਼ੀਏ ਨਾਲ ਡੋਰੀ ਦੇ ਧਾਗੇ ਨਾਲ ਲੈਸ ਬਣਾ ਕੇ ਮੈਂ ਇੱਕ ਚੁੰਨੀ ਦੇ ਆਲੇ ਦੁਆਲੇ ਵੀ ਲਗਾਈ ਜੋ ਕਿ ਬਹੁਤ ਹੀ ਸੁੰਦਰ ਅਤੇ ਆਕਰਸ਼ਿਤ ਬਣ ਗਈ ਸੀ